ਸ਼ਿਲਪਕਾਰੀ ਪੁਰਾਣੇ ਸਮਿਆਂ ਤੋਂ ਹੀ ਚੱਲਦੀ ਆ ਰਹੀ ਹੈ ਇਹ ਇੱਕ ਤਰ੍ਹਾਂ ਦਾ ਆਰਟ ਹੈ ਸ਼ਿਲਪਕਾਰੀ ਪੰਜਾਬੀ ਕੋਸ਼ ਅਨੁਸਾਰ ਸ਼ੈਲਪ ਤੋਂ ਭਾਵ ਕਾਰੀਗਰੀ ਹੁਨਰ ਤੋਂ ਲਿਆ ਜਾਂਦਾ ਹੈ ਖੂਬਸੂਰਤੀ ਲੋੜ ਮਿਹਨਤ ਅਤੇ ਕਾਰੀਗਰੀ ਦੀ ਮੁਹਾਰਤ ਇਸ ਦੇ ਪ੍ਰਮੁੱਖ ਤੱਤ ਹਨ ਲੋਕ ਸ਼ਿਲਪਕਾਰੀ ਦਾ ਘੇਰਾ ਬਹੁਤ ਵੱਡਾ ਅਤੇ ਪੁਰਾਣਾ ਹੈ ਪੁਰਾਣੀਆਂ ਮੂਰਤਾਂ ਪੱਥਰ ਮੋਹਰਾਂ ਇਸ ਦਾ ਸਬੂਤ ਦਿੰਦੀਆਂ ਹਨ ਪੁਰਾਣੇ ਸਮੇਂ ਵਿੱਚ ਮੂਲ ਰੂਪ ਵਿੱਚ ਇਹਨਾਂ ਦੀਆਂ ਦੋ ਸ਼੍ਰੇਣੀਆਂ ਬਣਾਈਆਂ ਜਾਂਦੀਆਂ ਸਨ ਪਹਿਲੀ ਮਰਦਾਂ ਦੁਆਰਾ ਸ਼ਿਲਪਕਾਰੀ ਕੀਤੀ ਜਾਂਦੀ ਸੀ ਜਿਸ ਵਿੱਚ ਟੋਕਰੇ ਛਿੱਕੂ ਛੱਜ ਮਿੱਟੀ ਦੇ ਭਾਂਡੇ ਲੱਕੜ ਦੀਆਂ ਵਸਤਾਂ ਜੁੱਤੀਆਂ ਗਹਿਣੇ ਆਦਿ ਬਣਾਏ ਜਾਂਦੇ ਸਨ ਸਾਡੇ ਰਾਜ ਵਿੱਚ ਕੁਝ ਪ੍ਰਸਿੱਧ ਕਲਾ ਪਰੰਪਰਾਵਾਂ ਹਨ ਜਿਸ ਵਿੱਚ ਇਸਤਰੀਆਂ ਦੁਆਰਾ ਮੰਜੇ ਬੁਣਨਾ ਬੋਹੀਏ ਇੰਨੂੰ ਪੀੜ੍ਹੀਆਂ ਚਟਾਈਆਂ ਦਰੀਆਂ ਖੇਸ ਰੁਮਾਲ ਦੁਪੱਟੇ ਸੂਟ ਫੁਲਕਾਰੀ ਚਾਦਰ ਬਾਗ ਸਰਾਣੇ ਮੇਜ ਪੋਸ਼ ਪੱਖੀਆਂ ਤਸਵੀਰਾਂ ਆਦਿ ਬਣਾਈਆਂ ਜਾਂਦੀਆਂ ਹਨ ਮਰਦਾਂ ਦੁਆਰਾ ਮਿੱਟੀ ਦੇ ਭਾਂਡੇ ਆਦਿ ਬਣਾਏ ਜਾਂਦੇ ਹਨ ਕਿਸੇ ਕਾਰੀਗਰ ਜਾਂ ਦਸਤਕਾਰੀ ਦਾ ਸੰਬੰਧ ਉਸ ਦੀ ਆਪਣੀ ਸ਼ਿਲਪ ਨਾਲ ਹੁੰਦਾ ਹੈ ਅਤੇ ਹੁਨਰ ਜਾਂ ਸ਼ਿਲਪ ਵਿੱਚ ਨਿਪੁੰਨ ਹੋਣਾ ਹੀ ਉਸ ਦੀ ਵਿਸ਼ੇਸ਼ਤਾ ਮੰਨੀ ਜਾਂਦੀ ਹੈ